ਹੈਲੋ ਸਤਿ ਸ਼੍ਰੀ ਅਕਾਲ ਮੈਮ ਮੈਂ ਜੈਦੀਪ ਗੱਲ ਕਰ ਰਹੀ ਹਾਂ ਹਾਂਜੀ ਮੈਮ ਮੈਂ ਮੈਮ ਤੁਹਾਡੇ ਨਾਲ ਗੱਲ ਕਰਨੀ ਸੀਗੀ ਕਿ ਤੁਸੀਂ ਸਾਡੇ ਡਿਪਾਰਟਮੈਂਟ ਦੇ ਇੰਚਾਰਜ਼ ਹੋ ਔਰ ਮੈਂ ਤੁਹਾਡੇ ਡਿਪਾਰਟਮੈਂਟ ਦੇ ਵਿੱਚ ਹੀ ਐਜ਼ ਏ ਪ੍ਰੋਫੈਸਰ ਜੋਬ ਕਰ ਰਹੀਂ ਹਾਂ ਕੰਪਿਊਟਰ ਸਾਇੰਸ ਡਿਪਾਰਟਮੈਂਟ ਦੇ ਵਿੱਚ ਅਤੇ ਮੈਨੂੰ ਮੇਰੇ ਮੈਮ ਨੇ ਤੁਹਾਡਾ ਨੰਬਰ ਦਿੱਤਾ ਸੀਗਾ ਕਿ ਮੈਂ ਤੁਹਾਡੇ ਨਾਲ ਕੋਲ ਕਰ ਸਕਦੀ ਹਾਂ ਕੁਛ ਡਿਸਕਸ਼ਨਸ ਕਰਨੀਆਂ ਸੀ ਜਿਸ ਦੇ ਰਿਗਾਰਡਿੰਗ ਮੈਨੂੰ ਨਾ ਡਿਫੀਕਲਟੀਸ ਫੇਸ ਹੋ ਰਹੀਆਂ ਸੀਗੀਆਂ ਹਾਂਜੀ ਤੋ ਮੈਮ ਸਾਡੇ ਕੋਲੇਜ ਦੇ ਵਿੱਚ ਜੋ ਕਲਾਸ ਰੂਮਜ਼ ਹੈਗੇ ਆ ਉਹ ਉਹਨਾਂ ਦੇ ਗੱਲ ਕਰਨੀ ਸੀਗੀ ਕਿ ਉਹਨਾਂ ਦੇ ਵਿੱਚ ਨਾ ਬੜੀ ਦਿੱਕਤ ਆ ਰਹੀ ਹੈ ਕਿ ਜਦੋਂ ਵੀ ਬੱਚੇ ਬੈਠਦੇ ਨੇ ਤਾਂ ਉਹਨਾਂ ਦਾ ਸੀਟਿੰਗ ਜਿਹੜਾ ਸਿਸਟਮ ਹੈਗਾ ਉਹ ਪ੍ਰੋਪਰ ਨਹੀਂ ਹੈਗਾ ਇੱਕ ਤਾਂ ਔਰ ਸਾਡੇ ਜਿਹੜੇ ਬਲੈਕ ਬੋਰਡਜ਼ ਨੇ ਉਹ ਬਿਲਕੁਲ ਖਰਾਬ ਹੋ ਚੁੱਕੇ ਨੇ ਅਤੇ ਉਹਨਾਂ ਦੀ ਜਗ੍ਹਾ 'ਤੇ ਸਾਨੂੰ ਵਾਈਟ ਬੋਰਡਜ਼ ਚਾਹੀਦੇ ਸੀਗੇ ਅਤੇ ਇੱਕ ਸਾਡੇ ਜਿਹੜੀ ਸੈਟਿੰਗ ਹੈਗੀ ਆ ਉਹ ਸਾਨੂੰ ਚੇਅਰਸ ਚਾਹੀਦੀਆਂ ਸੀਗੀਆਂ ਜਿਹੜੀਆਂ ਸਾਡੀਆਂ ਪੁਰਾਣੀਆਂ ਚੇਅਰਸ ਨੇ ਉਹ ਸਾਰੀਆਂ ਟੁੱਟ ਚੁੱਕੀਆਂ ਨੇ ਔਰ ਇੱਕ ਸਾਡੇ ਰੂਮਸ ਦੀ ਕਪੈਸਿਟੀ ਜਿਹੜੀ ਹੈਗੀ ਆ ਉਹ ਸਿਰਫ ਫਿਫਟੀਨ ਟੂ ਟਵੈਂਟੀ ਸਟੂਡੈਂਟਸ ਦੇ ਬੈਠਣ ਦੀ ਹੈ ਅਤੇ

ਹਾਂਜੀ ਬਟ ਜਿਹੜੇ ਸਾਡੇ ਇੰਨਚਾਰਜ ਮੈਮ ਨੇ ਉਹ ਕਹਿ ਰਹੇ ਸੀਗੇ ਕਿ ਇੱਕ ਵਾਰੀ ਤੁਹਾਡੇ ਨਾਲ ਗੱਲ ਕਰ ਲਵਾਂ ਸੋ ਦੈਟ ਕਿ ਤੁਸੀਂ ਯੂਨੀਵਰਸਿਟੀ ਦੇ ਵਿੱਚ ਅੱਗੇ ਸਾਡੇ ਜੋ ਵੀ ਇਸ਼ੂਜ ਨੇ ਉਹਨਾਂ ਨੂੰ ਅੱਗੇ ਹਾਈਲਾਈਟ ਕਰ ਸਕੋਂ ਸੋ ਉਹਨਾਂ ਨੇ ਕਿਹਾ ਸੀਗਾ ਕੇ ਹੂੰ ਅ ਹਾਂਜੀ ਅਤੇ ਮੈਂ ਇਹੀ ਗੱਲ ਕਰਨੀ ਸੀਗੀ ਕਿ ਇੱਕ ਤਾਂ ਤੁਹਾਡੇ ਨਾਲ ਡਿਸਕਸ਼ਨ ਹੋ ਗਈ ਹੈ ਮੇਰੀ ਔਰ ਇਸ ਦੇ ਰਿਗਾਰਡਿੰਗ ਮੈਂ ਤੁਹਾਨੂੰ ਇੱਕ ਮੇਲ ਵੀ ਡਰਾਫਟ ਕਰ ਦਿਆਂਗੀ ਜਿਹਦੇ ਵਿੱਚ ਸਾਰੀਆਂ ਪ੍ਰੋਬਲਮ ਸ਼ੇਅਰ ਕਰ ਦਾਂਗੀ ਕਿ ਸਾਡੀ ਸੀਟਿੰਗ ਕੰਪੈਸਟੀ ਇਨਕ੍ਰੀਜ਼ ਕੀਤੀ ਜਾਵੇ ਔਰ ਜਿਹੜੀ ਸੀਟਿੰਗ ਫੈਸਿਲਿਟੀ ਹੈਗੀ ਆ ਮਤਲਬ ਚੇਅਰ ਵਗੈਰਾ ਹੈਗੇ ਹੈ ਡੈਕਸਿਸ ਹੈਗੇ ਹੈ ਉਹ ਸਾਨੂੰ ਪ੍ਰੋਵਾਈਡ ਕਰਵਾ ਦਿੱਤੇ ਜਾਣ ਔਰ ਵਾਈਟ ਬੋਰਡਸ ਦਾ ਅਤੇ ਅਗਰ ਹਾਂਜੀ ਹਾਂਜੀ ਮੈਂ ਬਿਲਕੁਲ ਕਰ ਦਿਆਂਗੀ ਮੈਂ ਮਤਲਬ ਤੁਹਾਨੂੰ ਫੋਰਵਰਡ ਕਰ ਦਿਆਂਗੀ ਮੇਲ ਔਰ ਮੈਮ ਨੂੰ ਵੀ ਲੂਪ ਕਰ ਦਿਆਂਗੀ ਤੋ ਅਗਰ ਮੈਮ ਦੀ ਤੁਹਾਨੂੰ ਕੋਲ ਆਉਂਦੀ ਆ ਤਾਂ ਪਲੀਜ਼ ਤੁਸੀਂ ਇੱਕ ਵਾਰੀ ਉਹਨਾਂ ਦੇ ਨਾਲ ਮਤਲਬ ਉਹਨਾਂ ਨੂੰ ਦੱਸ ਦੇਣਾ ਕਿ ਹਾਂਜੀ ਤੁਹਾਡੇ ਪ੍ਰੋਫੈਸਰ ਦੀ ਮੈਨੂੰ ਕੋਲ ਆ ਗਈ ਸੀਗੀ ਅਤੇ ਚੀਜ਼ਾਂ ਡਿਸਕਸ ਹੋ ਗਈਆਂ ਸੀਗੀਆਂ ਮਾਈ ਗੁੱਡ ਨੇਮ ਇਜ਼ ਜੈਦੀਪ ਔਰ ਸਾਡੇ ਮੈਮ ਜਿਹੜੇ ਨੇ ਉਹ ਤੁਸੀਂ ਜਾਣਦੇ ਹੀ ਹੋਉਂਗੇ ਉਹਨਾਂ ਨੂੰ ਨਵ ਨਾਮ ਹੈਗਾ ਉਹਨਾਂ ਦਾ ਨਵਪ੍ਰੀਤ ਹਾਂਜੀ ਸੋ ਠੀਕ ਹੈ ਮੈਮ ਥੈਂਕ ਯੂ ਥੈਂਕ ਯੂ ਫੋਰ ਯੂਅਰ ਟਾਈਮ ਥੈਂਕ ਯੂ